ਅ ਗੱਲ ਕਰੀਏ ਮੇਰੇ ਖੇਤਰ ਦੇ ਵਿੱਚ ਜਿਹੜਾ ਸਤਲੁਜ ਦਰਿਆ ਮੈਨੂੰ ਕਾਫੀ ਨੇੜੇ ਪੈਂਦਾ ਹੈ ਅਤੇ ਇੱਥੇ ਬਹੁਤ ਜ਼ਿਆਦਾ ਵਧੀਆ ਲੋਕੇਸ਼ਨ 'ਤੇ ਹੈ ਅਤੇ ਇੱਥੇ ਜੇ ਗੱਲ ਕਰੀਏ ਆਪਾਂ ਕੰਮ ਕਰਨਾ ਹੋਵੇ ਤਾਂ ਇੱਥੇ ਨਾ ਆਪਾਂ ਰੈਸਟੋਰੈਂਟ ਵਗੈਰਾ ਯਾ ਢਾਬਾ ਵਗੈਰਾ ਬਹੁਤ ਵਧੀਆ ਤਰੀਕੇ ਨਾਲ ਚਲਾ ਸਕਦੇ ਹੈ ਕਿਉਂਕਿ ਇੱਥੇ ਜ਼ਿਆਦਾ ਮੌਸਟਲੀ ਲੋਕ ਸਵੇਰ ਸ਼ਾਮ ਇੱਥੇ ਘੁੰਮਣ ਫਿਰਨ ਆਉਂਦੇ ਨੇ ਅਤੇ ਬਾਹਰ ਤੋਂ ਸੈਲਾਨੀ ਵੀ ਇੱਥੇ ਵਿਜ਼ਟ ਕਰਦੇ ਰਹਿੰਦੇ ਨੇ